ਭੰਗੜਾ ਐਰੋਬਿਕਸ ਸਿਹਤ ਨੂੰ ਚੁਸਤੀ ਫੁਰਤੀ ਪ੍ਰਦਾਨ ਕਰਦਾ ਹੈ ਜਦੋਂ ਵੀ ਮੈਂ ਆਪਣੇ ਆਪ ਨੂੰ ਚਿੰਤਾ ਵਿੱਚ ਪਾਇਆ ਦਿੰਦਾ ਹਾਂ ਤਾਂ ਮੈਂ ਆਪਣੇ ਆਪ ਨੂੰ ਨੈਗਟਿਵ ਸੋਚ ਨਾਲ ਘਿਰਿਆ ਮਹਿਸੂਸ ਕਰਦਾ ਹਾਂ ਤਾਂ ਮੈਨੂੰ ਇੱਕੋ ਹੱਲ ਮਹਿਸੂਸ ਹੁੰਦਾ ਹੈ ਅਤੇ ਮੈਂ ਭੰਗੜੇ ਦੇ ਪੰਜਾਬੀ ਗਾਣੇ ਲਗਾ ਕੇ ਭੰਗੜਾ ਪਾਣਾ ਸ਼ੁਰੂ ਕਰ ਦਿੰਦਾ ਹਾਂ ਹਾਂ ਵੈਸੇ ਤਾਂ ਭੰਗੜਾ ਲੋਕ ਗੀਤ ਵਾਰਾਂ ਅਤੇ ਬੋਲੀਆਂ 'ਤੇ ਪਾਇਆ ਜਾਂਦਾ ਹੈ ਅੱਜ ਕੱਲ੍ਹ ਭੰਗੜਾ ਪੰਜਾਬੀ ਗਾਣੇ 'ਤੇ ਪਾਇਆ ਜਾਂਦਾ ਹੈ ਜਦੋਂ ਜਿਵੇਂ ਕਿ ਦੇਦੇ ਗੇੜਾ ਸ਼ੌਂਕ ਦਾ ਨਨਾਣੇ ਗੋਰੀਏ ਐਂ ਜੀਜੇ ਦਾ ਦਿਲ ਦਰਿਆ ਸਾਲੀਏ ਜੱਟਾਂ 'ਤੇ ਕੇਸ ਚੱਲਦਾ ਟੇਡੀ ਪੱਗ ਵਾਲਿਆ ਮੈਨੂੰ ਸਾਨੂੰ ਟੇਡੀ ਟੇਡੀ ਤੱਕਦੀ ਤੂੰ ਲੋ ਲੱਕ ਟਵੰਟੀ ਕੁੜੀ ਦਾ ਹੂੰ ਹੂੰ ਕਾਲੀ ਐਕਟਿਵਾ ਦਾ ਖੜ੍ਹ ਗਿਆ ਹਾਂ ਹਾਂ ਹੈਂਡਲ ਫੜ ਕੇ ਚੱਲਦਾ ਫਿਰ ਨੱਚਦਾ ਫਿਰੇ ਆਪਣੇ ਵਿਆਹ ਵਿੱਚ ਊ ਹੂ ਤੂੰ ਗਿੱਧਿਆਂ ਦੀ ਰਾਣੀ ਮੈਂ ਭੰਗੜੇ ਦਾ ਰਾਜਾ ਹੋਰ ਭੰਗੜਾ ਪਾ ਕੇ ਮਨ ਨੂੰ ਸਕੂਨ ਅਤੇ ਸ਼ਾਂਤੀ ਮਿਲਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ